ਤਰਸੇਮ ਜੱਸੜ ਪੰਜਾਬੀ ਫਿਲਮ ਅਤੇ ਸੰਗੀਤ ਇੰਡਸਟਰੀ ਦਾ ਉਹ ਸਿਤਾਰਾ ਹੈ ਜਿਸਨੇ ਬਹੁਤ ਘੱਟ ਸਮੇਂ ਸ਼ੁਹਰਤ ਦੀਆਂ ਬੁਲੰਦੀਆਂ ਨੂੰ ਛੂਹਿਆ ਹੈ ਆਪਣੇ ਗੀਤਾਂ ਅਤੇ ਫਿਲਮਾਂ ਨਾਲ ਮਨੋਰੰਜਨ ਦੀ ਦੁਨੀਆ ਵਿੱਚ ਵੱਖਰੀ ਪਛਾਣ ਬਣਾਉਣ ਵਾਲਾ ਤਰਸੇਮ ਖੁਦ ਨੂੰ ਖੁਸ਼ਕਿਸਮਤ ਮੰਨਦਾ ਹੈ ਕਿ ਉਸਨੂੰ ਸਰੋਤਿਆਂ ਨੇ ਇੰਨਾ ਪਿਆਰ ਦਿੱਤਾ ਹੈ ਅੱਜ ਉਸਦੇ ਗੀਤਾਂ ਅਤੇ ਫਿਲਮਾਂ ਦਾ ਉਸਦੇ ਪ੍ਰਸ਼ੰਸਕਾਂ ਨੂੰ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਮਿਆਰੀ ਗੀਤ ਲਿਖਣ ਵਾਲਾ ਗੀਤਕਾਰ ਅਤੇ ਗਾਇਕ ਹੋਣ ਦੇ ਨਾਲ ਨਾਲ ਤਰਸੇਮ ਜੱਸੜ ਇੱਕ ਸੰਜੀਦਾ ਕਿਰਦਾਰ ਨਿਭਾਉਂਦਾ ਨਿਭਾਉਣ ਵਾਲਾ ਦਮਦਾਰ ਅਕਾਦ ਅਦਾਕਾਰ ਵੀ ਹੈ ਉਹ ਆਪਣੇ ਗੀਤਾਂ ਨੂੰ ਲੈ ਕੇ ਅਕਸਰ ਚਰਚਾ 'ਚ ਬਣਿਆ ਰਹਿੰਦਾ ਹੈ ਉਹ ਭੀੜ ਨਾਲੋਂ ਹਟ ਕੇ ਤੁਰਨ ਦਾ ਸ਼ੌਕ ਰੱਖਦਾ ਹੈ ਉਸ ਦੇ ਲੇਖ ਉਸਦੇ ਲਿਖੇ ਗੀਤਾਂ 'ਚ ਇੱਕ ਸੱਚ ਵੀ ਛੁਪਿਆ ਹੋਇਆ ਹੈ ਜੋ ਸਮਾਜ ਨੂੰ ਕਈ ਵਾਰ ਸ਼ੀਸ਼ਾ ਵਿਖਾਉਣ ਦਾ ਕੰਮ ਵੀ ਬਾਖੂਬੀ ਕਰਦਾ ਹੈ ਤਰਸੇਮ ਜੱਸੜ ਦਾ ਜਨਮ ਚਾਰ ਜੁਲਾਈ ਉੱਨੀ ਸੌ ਛਿਆਸੀ ਨੂੰ ਪਿੰਡ ਜੱਸੜ ਤਹਿਸੀਲ ਢੇਲੋਂ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਬਾਅਦ 'ਚ ਉਸ ਦਾ ਸਾਰਾ ਪਰਿਵਾਰ ਪਿੰਡ ਅਮਲੋਹ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ ਪੱਕੇ ਤੌਰ 'ਤੇ ਆ ਵੱਸਿਆ ਇੱਥੇ ਹੀ ਤਰਸੇਮ ਨੇ ਸਰਕਾਰੀ ਸਕੂਲ ਤੋਂ ਆਪਣੀ ਬਾਰਵੀਂ ਤੱਕ ਦੀ ਮੁੱਢਲੀ ਪੜ੍ਹਾਈ ਪੂਰੀ ਕੀਤੀ ਇਸ ਤੋਂ ਬਾਅਦ ਉਸਨੇ ਮਾਤਾ ਗੁਜਰੀ ਕੋਲਜ ਫਤਿਹਗੜ੍ਹ ਸਾਹਿਬ ਵਿਖੇ ਬੀ ਐੱਸ ਸੀ ਦੀ ਡਿਗਰੀ ਹਾਸਲ ਕਰਨ ਲਈ ਦਾਖਲਾ ਲਿਆ ਇਸ ਕੋਲਜ 'ਚ ਹੀ ਤਰਸੇਮ ਨੂੰ ਮਸ਼ਹੂਰ ਗਾਇਕ ਕੁਲਬੀਰ ਝਿੰਜਰ ਜਿਹੇ ਦੋਸਤਾਂ ਦਾ ਸਾਥ ਮਿਲਿਆ ਜ਼ਿਕਰਯੋਗ ਹੈ ਕਿ ਕੁਛ ਸਮਾਂ ਤਰਸੇਮ ਕੋਲਜ ਯੂਨੀਅਨ ਦਾ ਪ੍ਰਧਾਨ ਵੀ ਰਿਹਾ ਫਿਰ ਉਸਨੇ ਐੱਮ ਐੱਮ ਐੱਸ ਸੀ 'ਚ ਦਾਖਲਾ ਲਿਆ ਪਰ ਇਸ ਦੌਰਾਨ ਹੀ ਉਸਦਾ ਇੰਗਲੈਂਡ ਦਾ ਵੀਜ਼ਾ ਲੱਗ ਗਿਆ ਅਤੇ ਉਹ ਆਪਣੀ ਪੜ੍ਹਾਈ ਵਿਚਕਾਰ ਹੀ ਛੱਡ ਕੇ ਦੋ ਹਜ਼ਾਰ ਨੌ 'ਚ ਇੰਗਲੈਂਡ ਆਪਣੀ ਵੱਡੀ ਭੈਣ ਕੋਲ ਚਲਾ ਗਿਆ ਇੰਗਲੈਂਡ ਪਹੁੰਚ ਕੇ ਉਸਨੇ ਸੁਪਨਿਆਂ ਦੀ ਦੁਨੀਆ ਤੋਂ ਬਾਹਰ ਨਿਕਲ ਅਸਲ ਦੁਨੀਆ ਨੂੰ ਜਾਨਣ 'ਚ ਸ ਮੌਕਾ ਮਿਲਿਆ ਅਗਰ ਮੈਨੂੰ ਉਹ ਮਿਲਣ ਅਗਰ ਮੈਨੂੰ ਮੌਕਾ ਮਿਲਦਾ ਹੈ ਵੀ ਉਹਨੂੰ ਮਿਲਣ ਦਾ ਤਾਂ ਮੈਂ ਸਭ ਤੋਂ ਪਹਿਲਾਂ ਉਸਨੂੰ ਉਸਦਾ ਹਾਲ ਚਾਲ ਪੁੱਛਾਂਗੀ ਅਤੇ ਉਸਦੀ ਗਾਇਕਾ ਦੀ ਗਾਇਕੀ ਦੀ ਪ੍ਰਸ਼ੰਸਾ ਕਰਾਂਗੀ ਅਗਰ ਹੋਰ ਕੁਛ ਵੀ ਪੁੱਛਣ ਦਾ ਮੌਕਾ ਮਿਲਦਾ ਹੈ ਮੈਂ ਉਹਨਾਂ ਨੂੰ ਉਹਨਾਂ ਜਜ਼ਬਾਤਾਂ ਨੂੰ ਗੀਤਾਂ ਦੀ ਮਾਲਾ 'ਚ ਪਰੋਣਾ ਸਿੱਖ ਸਿੱਖਾਂਗੀ ਤਰਸੇਮ ਦਾ ਲਿਖਿਆ ਪਹਿਲਾ ਗੀਤ ਉਸਦੇ ਦੋਸਤ ਕੁਲਬੀਰ ਝਿੰਜਰ ਦੀ ਆਵਾਜ਼ 'ਚ ਰਿਕੋਡ ਹੋਇਆ ਉਹਦੇ ਬਾਰੇ ਵੀ ਮੈਂ ਜਾਣਕਾਰੀ ਲੈਣਾ ਪਸੰਦ ਕਰਾਂਗੀ